ਲੋਕਡਾਊਨ ਦਾ ਸਮਾਂ ਸਾਡੇ ਮਤਲਬ ਮੇਰੇ ਅਤੇ ਮੇਰੇ ਪਰਿਵਾਰਾਂ ਦੇ ਲਈ ਅਤੇ ਹੋਰ ਲੋਕਾਂ ਲਈ ਵੀ ਬਹੁਤ ਔਖਾ ਸਮਾਂ ਰਿਹਾ ਹੈ ਅਤੇ ਅਸੀਂ ਇਹਦੇ ਵਿੱਚ ਮਤਲਬ ਬਾਹਰ ਜਾ ਕੁਛ ਖਾ ਨਹੀਂ ਸਕਦੇ ਸੀ ਜਿੱਦਾਂ ਪਹਿਲਾਂ ਜਾ ਕੇ ਖਾ ਲੈਂਦੇ ਸੀ ਤਾਂ ਫਿਰ ਅਸੀਂ ਮਤਲਬ ਸਾਨੂੰ ਮਤਲਬ ਬਾਹਰ ਦੀ ਚੀਜ਼ ਖਾਣ ਦਾ ਮਨ ਕਰਦਾ ਸੀ ਅਤੇ ਫਿਰ ਸਾਰੇ ਦੁਕਾਨਾਂ ਵੀ ਬੰਦ ਹੁੰਦੀਆਂ ਸੀ ਅਤੇ ਫਿਰ ਅਸੀਂ ਕਿਆ ਕਰਿਆ ਕਿ ਮਤਲਬ ਜਿਵੇਂ ਕਿ ਹੋ ਗਏ ਸਮੋਸੇ ਛੋਲੇ ਅਤੇ ਕੁਲਚੇ ਵਗੈਰਾ ਚਾਹੇ ਨੂਡਲ ਵਗੈਰਾ ਖਾਣ ਦਾ ਜੀਅ ਕਰਦਾ ਸੀ ਤਾਂ ਫਿਰ ਅਸੀਂ ਬਣਾ ਨਹੀਂ ਸਕਦੇ ਮਤਲਬ ਜਾ ਨਹੀਂ ਸਕਦੇ ਸੀ ਤਾਂ ਫਿਰ ਅਸੀਂ ਕ ਕਿਆ ਕਰਿਆ ਕਿ ਮਤਲਬ ਮੈਂ ਫ਼ੋਨ 'ਚ ਦੇਖਦੀ ਸੀ ਮਤਲਬ ਖਾਣ ਦਾ ਜੀਅ ਬਹੁਤ ਕਰਦਾ ਸੀ ਤਾਂ ਫਿਰ ਮੈਂ ਮਤਲਬ ਮੈਂ ਇੱਕ ਦਿਨ ਘਰ ਹੀ ਬਣਾ ਕੇ ਦੇਖਿਆ ਕਿ ਮਤਲਬ ਕਿੱਦਾਂ ਬਣਦਾ ਕਿੱਦਾਂ ਨਹੀਂ ਤਾਂ ਫੇਰ ਫਿਰ ਮੈਂ ਤਾਂ ਸਮੋਸੇ ਬਣਾਏ ਪਹਿਲਾਂ ਤਾਂ ਫਿਰ ਪਹਿਲਾਂ ਤਾਂ ਮੈਂ ਸਮੋਸੇ ਮਤਲਬ ਜਿਵੇਂ ਮੈਂ ਮੈਂ ਮੈਦਾ ਲੈ ਕੇ ਮਤਲਬ ਸਮਾਨ ਤਾਂ ਘਰ ਹੀ ਸੀ ਮਤਲਬ ਮੈਦਾ ਲੈ ਕੇ ਮੈਂ ਗੁੰਨ ਤਾ ਫੇਰ ਉਹਨੂੰ ਮਤਲਬ ਵੇਲ ਕੇ ਫਿਰ ਆਲੂ ਵੀ ਭੁੱਜ ਗਏ ਫਿਰ ਉਹਦੇ ਵਿੱਚ ਪਾ ਲਿਆ ਅਤੇ ਫਿਰ ਮਤਲਬ ਫਿਰ ਉਹਨੂੰ ਤਲ ਕੇ ਫਿਲ ਫਿਰ ਛੋਲੇ ਬਣਾ ਤੇ ਫਿਰ ਮਤਲਬ ਛੋਲੇ ਅਤੇ ਸਮੋਸੇ ਖਾਏ ਫਿਰ ਉਤੇ ਅਗਲੇ ਦਿਨ ਅਸੀਂ ਮਤਲਬ ਕੁਲਚੇ ਛੋਲੇ ਬਣਾਏ ਅਤੇ ਫਿਰ ਅਸੀਂ ਮਤਲਬ ਜਿਵੇਂ ਕਿ ਮਤਲਬ ਬਰੈੱਡ ਵਗੈਰਾ ਵੀ ਘਰ ਹੀ ਸੀ ਤਾਂ ਫਿਰ ਅਸੀਂ ਬਰੈੱਡ ਨੂੰ ਗਰਮ ਕੀਤਾ ਅਤੇ ਗਰਮ ਕਰਕੇ ਅਤੇ ਛੋਲੇ ਜਿਹੜੇ ਹੁੰਦੇ ਉਹਨੂੰ ਮਤਲਬ ਪਿਆਜ਼ ਵਗੈਰਾ ਮਸਾਲੇ ਵਿੱਚ ਭੁੱਜ ਗਏ ਅਤੇ ਫਿਰ ਉਹਦੇ ਵਿੱਚ ਪਾ ਕੇ ਮਤਲਬ ਘਰ ਹੀ ਮਤਲਬ ਬਣਾ ਕੇ ਖਾ ਲਿਆ ਮਤਲਬ ਮੇਰੇ ਪਾਪਾ ਵੀ ਬਹੁਤ ਖੁਸ਼ ਹੋਏ ਮਤਲਬ ਪੈਸੇ ਵੀ ਬਚ ਗਏ ਸਾਡੇ ਅਤੇ ਫਿਰ ਮਤਲਬ ਬਾਹਰ ਵੀ ਜਾਣ ਦੀ ਕੋਈ ਲੋੜ ਨਹੀਂ ਹੋਈ ਅਤੇ ਫਿਰ ਮਤਲਬ ਬਾਹਰ ਦਾ ਸਮਾਨ ਅਸੀਂ ਘਰ ਵੀ ਖਾ ਲਿਆ ਲੰਮੇ ਇਹਤੇ ਇਹ ਇਹਦੇ ਨਾਲ਼ ਸਾਡੀ ਮਤਲਬ ਸਿਹਤ ਵੀ ਸੀ ਠੀਕ ਰਹੀ ਅਤੇ ਅਸੀਂ ਇਨਫੈਕਸ਼ਨ ਨਾਲ਼ ਵੀ ਬਚੇ ਰਹੇ ਫਿਰ ਵਧੀਆ ਹੈ ਕਿ ਮਤਲਬ ਕਿ ਅਸੀਂ ਮਤਲਬ ਘਰ ਬਣਾ ਕੇ ਖਾ ਲਿਆ ਮਤਲਬ ਸਾਨੂੰ ਤਾਂ ਬਹੁਤ ਅੱਛਾ ਮਤਲਬ ਵਧੀਆ ਲੱਗਿਆ ਅਤੇ ਮੈਂ ਦੂਜਿਆਂ ਨੂੰ ਵੀ ਕਹਿੰਦੀ ਹਾਂ ਕਿ ਮਤਲਬ ਤੁਸੀਂ ਬਣਾ ਕੇ ਖਾਇਆ ਕਰੋ ਬਾਹਰ ਜਾਣ ਤੋਂ ਵਧੀਆ ਹੁੰਦਾ ਘਰ ਦਾ ਸਮਾਨ